ਸ਼ੋਸ਼ਲ ਮੀਡੀਆ ਦੇ ਰਾਹੀਂ ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਘਰ ਬੈਠੇ ਹੀ ਕਲਾ ਅਤੇ ਸ਼ਿਲਪਕਾਰੀ ਦੀ ਜਾਣਕਾਰੀ ਮਿਲ ਜਾਂਦੀ ਹੈ ਲੋਕ ਆਪਣੇ ਆਪਣੇ ਹੁਨਰਾਂ ਨੂੰ ਸ਼ੋਸ਼ਲ ਮੀਡੀਆ ਦੁਆਰਾ ਲੋਕਾਂ ਤੱਕ ਪਹੁੰਚਾਉਂਦੇ ਹਨ ਬਹੁਤ ਯੂਟਿਊਬ ਚੈਨਲ ਹਨ ਜੋ ਲੋਕਾਂ ਦੇ ਹੁਨਰ ਨੂੰ ਸਪੋਟ ਕਰਦੇ ਹਨ